ਦਸ ਮਾਰਚ ਦੋ ਹਜ਼ਾਰ ਪੰਜ ਪੰਜ ਮਾਰਚ ਦੋ ਹਜ਼ਾਰ ਵੀਹ ਤਿੰਨ ਸਤੰਬਰ ਦੋ ਹਜ਼ਾਰ ਬਾਈ ਚਾਰ ਅਗਸਤ ਦੋ ਹਜ਼ਾਰ ਸੌਲ੍ਹਾਂ ਪੰਜ ਅਗਸਤ ਦੋ ਹਜ਼ਾਰ ਉੱਨੀ